ਪਟਿਆਲਾ ਜ਼ਿਲ੍ਹਾ ਬਹੁਤ ਹੀ ਵਿਸ਼ਾਲ ਜ਼ਿਲ੍ਹਾ ਹੈ ਇੱਥੇ ਕਈ ਯੂਨੀਵਰਸਿਟੀਆਂ ਵੀ ਹਨ ਜਿਵੇਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਜੀਵ ਯੂਨੀਵਰਸਿਟੀ ਥਾਪਰ ਯੂਨੀਵਰਸਿਟੀ ਪਟਿਆਲੇ ਜ਼ਿਲ੍ਹੇ ਨੂੰ ਐਜੂਕੇਸ਼ਨ ਹੱਬ ਵੀ ਕਿਹਾ ਜਾਂਦਾ ਹੈ ਡੀ ਸੀ ਡਬਲਿਊ ਬਹੁਤ ਵੱਡਾ ਹੈ ਡੈਰੀ ਉਦਯੋਗ ਵੇਰਕਾ ਮਾ ਮਿਲਕ ਪਲਾਂਟ ਵੀ ਪਟਿਆਲੇ ਜ਼ਿਲ੍ਹੇ ਵਿੱਚ ਸਥਾਪਿਤ ਹੈ ਇੱਥੇ ਇੱਕ ਸਕੋਰਡ ਫੈਕਟਰੀ ਵੀ ਹੈ ਪਟਿਆਲੇ ਜ਼ਿਲ੍ਹੇ ਵਿੱਚ ਕਈ ਪੁਰਾਣੇ ਮਹਿਲ ਵੀ ਪਾਏ ਜਾਂਦੀ ਨੇ ਇੱਥੇ ਦੇ ਬਜ਼ਾਰ ਵੀ ਬਹੁਤ ਹੀ ਵਿਸ਼ਾਲ ਹਨ ਇੱਥੇ ਦੇ ਬਜ਼ਾਰਾਂ ਵਿੱਚ ਬੜੀ ਹੀ ਰੌਣਕ ਹੁੰਦੀ ਹੈ ਪਟਿਆਲਾ ਪਟਿਆਲਾ ਹੱਬ ਬਹੁਤ ਹੀ ਵਧੀਆ ਹੱਬ ਹੈ ਪਟਿਆਲੇ ਵਿੱਚ ਸਿੱਖਿਆ ਦੇ ਸਾਧਨ ਵੀ ਬਹੁਤ ਜ਼ਰੂਰੀ ਹਨ